ਚਾਰ ਜੁਲਾਈ ਉੱਨੀ ਸੌ ਚੁਰਾਸੀ ਸੋਲ੍ਹਾਂ ਜਨਵਰੀ ਉੱਨੀ ਸੌ ਬਾਹਠ ਤੀਹ ਨਵੰਬਰ ਉੱਨੀ ਸੌ ਅਠਾਸੀ ਬਾਰਾਂ ਮਾਰਚ ਉੱਨੀ ਸੌ ਛਿਆਸੀ ਬਾਈ ਜੂਨ ਉੱਨੀ ਸੌ ਨੜ੍ਹਿਨਵੇਂ